ਛੋਟੇ ਹੁੰਦੇ ਤਾਂ ਬਹੁਤ ਖੇਡਾਂ ਖੇਡੀਆਂ ਜਿਵੇਂ ਕਿ ਉਦੋਂ ਖੇਡਾਂ ਹੀ ਇਹੋ ਹੁੰਦੀਆਂ ਸੀ ਖੋ ਖੋ ਲੁਕਣ ਛਿੱਪੀ ਬਾਂਦਰ ਕਿਲਾ ਵੱਡੇ ਹੋਏ ਫਿਰ ਖੇਡਾਂ ਬਦਲ ਗਈਆਂ ਬੈਟ ਬੋਲ 'ਤੇ ਆ ਗਏ ਚਿੜੀ ਛਿੱਕੇ 'ਤੇ ਆ ਗਏ ਘਰ ਲੁੱਡੋ ਕੈਰਮ ਬੋਰਡ ਖੇਡੀਦਾ ਸੀਗਾ ਅੱਜ ਦੇ ਟਾਈਮ 'ਚ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ ਅਸੀਂ ਇਸ ਕਰਕੇ ਇਹ ਚੀਜ਼ਾਂ ਖੇਡਦੇ ਸੀਗੇ ਇਹਨਾਂ ਨੂੰ ਖੇਡ ਕੇ ਮਨ ਤਰੋ ਤਾਜ਼ਾ ਹੁੰਦਾ ਸੀ ਚਾਰ ਬੰਦੇ ਆਪਸ 'ਚ ਮਿਲਦੇ ਸੀ ਗੱਲਾਂ ਕਰਦੇ ਸੀ ਅੱਜ ਦੇ ਟਾਈਮ 'ਚ ਕਿਸੇ ਕੋਲ ਇਹ ਚੀਜ਼ ਹੈ ਹੀ ਨਹੀਂ ਕਿ ਅਸੀਂ ਘਰ ਕਿਸੇ ਦੇ ਚਲੇ ਜਾਈਏ ਅਤੇ ਉਹਨੂੰ ਨਾਲ਼ ਖੇਡੀਏ ਉਹਨੂੰ ਆਪਣੇ ਕੰਮ ਪਏ ਨੇ ਸਾਨੂੰ ਆਪਣੇ ਕੰਮ ਪਏ ਨੇ ਸ਼ਾਨਦਾਰ ਜਿਹੜੀ ਚੀਜ਼ ਉਹ ਇਹ ਸੀ ਇਹੋ ਹੀ ਹੁੰਦੀ ਹੈ ਜਦੋਂ ਅਸੀਂ ਕੋਈ ਫਿਜੀਕਲੀ ਜਾਂ ਸਰੀਰਿਕ ਤੌਰ 'ਤੇ ਗੇਮ ਖੇਡਦੇ ਹਾਂ ਉਹ ਸਾਨੂੰ ਵੈਸੇ ਹੀ ਥੋੜ੍ਹੀ ਭੱਜ ਨੱਠ ਕਰਾ ਦਿੰਦੀ ਹੈ ਨਾਲ਼ੇ ਖੇਡਣ ਦਾ ਜਿਹੜਾ ਚਾਅ ਹੁੰਦਾ ਉਹ ਜ਼ਿਆਦਾ ਹੁੰਦਾ ਬਾਕੀ ਜਿਹੜੀ ਖੇਡ ਅਸੀਂ ਖੇਡਦੇ ਸੀਗੇ ਉਹ ਖੇਡਾਂ ਹੁਣ ਬੱਚਿਆਂ ਨੂੰ ਤਾਂ ਪਤਾ ਵੀ ਨਹੀਂ ਹੈਗੀਆਂ ਜਿਹੜੀਆਂ ਮੈਂ ਪਹਿਲੇ ਪਹਿਲੇ ਬੋਲੀਆਂ